ਮੋਹਾਲੀ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਰੋਜ਼ੀ ਰੋਟੀ ਦੇ ਬਹੁਤ ਸਾਰੇ ਸਾਧਨ ਹਨ ਜੀਕਣ ਕਿ ਖੇਤੀਬਾੜੀ ਹੋ ਗਈ ਅਤੇ ਮੋਹਾਲੀ ਜ਼ਿਲ੍ਹੇ ਵਿੱਚ ਆਪਣਾ ਉਦਯੋਗ ਲੱਗੇ ਹੋਏ ਹੈ ਇੰਡਸਟੀ ਏਰੀਆ ਹੈ ਲੇਡੀਜ ਵਾਸਤੇ ਬਹੁਤ ਜ਼ਿਆਦੀਆਂ ਮਿੱਲਾਂ ਖੁੱਲ੍ਹੀਆਂ ਹੋਈਆਂ ਜਿਹਦੇ ਵਿੱਚ ਉਹ ਕੰਮ ਕਰਦੀਆਂ ਹਨ ਅਤੇ ਆਪਣਾ ਘਰਾਂ ਦੇ ਵਿੱਚ ਬੀਬੀਆਂ ਸਿਲਾਈ ਵੀ ਕਰਦੀਆਂ ਹਨ ਅਤੇ ਜੈਂਟਸ ਵੀ ਕੋਈ ਵੀ ਮਤਲਬ ਕਿ ਭੁੱਖਾ ਨਹੀਂ ਮਰਦਾ ਹੈਗਾ ਹੱਥੀ ਕੰਮ ਸਾਰੇ ਜਾਣਦੇ ਹਨ ਅਤੇ ਜਿੱਥੇ ਤੱਕ ਹੋ ਸਕੇ ਤਾਂ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਇਹੋ ਜਿਹਾ ਕੰਮ ਸਿਖਾਇਆ ਜਾਵੇ ਪੜ੍ਹਨ ਦੇ ਨਾਲ਼ ਨਾਲ਼ ਜਿਸ ਤਰ੍ਹਾਂ ਸਿਲਾਈ ਕਢਾਈ ਹੋ ਗਈ ਅਤੇ ਲੜਕਿਆਂ ਵਾਸਤੇ ਕੁਝ ਡਰਾਇੰਗ ਹੋ ਗਈ ਕੁਛ ਹੋਰ ਚੀਜ਼ਾਂ ਸਲਖ ਸਿਖਲਾਈਆਂ ਜਾਣ ਤਾਂ ਕਿ ਉਹ ਬੱਚੇ ਅੱਗੇ ਵਧਣ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਹੁਣ ਬੇਰੁਜ਼ਗਾਰੀ ਅੱਧੀ ਖਤਮ ਹੋ ਗਈ ਹੈ ਅਤੇ ਉਹ ਨਾਲ਼ ਦੀ ਨਾਲ਼ ਹੋਰ ਬੇਰੁਜ਼ਗਾਰੀ ਵਾਸਤੇ ਵੀ ਕੁਛ ਕਦਮ ਚੱਕਣ